ਚੰਨ ਪ੍ਰਿਥਵੀ ਦਾ ਇਕਲੌਤਾ ਕੁਦਰਤੀ ਉਪਗ੍ਰਹਿ ਹੈ ਜਿਸ ਦੀ ਉਮਰ ਚਾਰ ਪੁਆਇੰਟ ਪੰਜ ਤਿੰਨ ਬਿਲੀਅਨ ਸਾਲ ਹੈ ਇਸਦੀ ਧਰਤੀ ਨਾਲੋਂ ਦੂਰੀ ਤਿੰਨ ਲੱਖ ਚੁਰਾਸੀ ਹਜ਼ਾਰ ਚਾਰ ਸੌ ਕਿਲੋਮੀਟਰ ਸਕੇਅਰ ਹੈ ਤਾਂ ਚੰਨ ਇਕਲੌਤਾ ਉਪ ਗ੍ਰਹਿ ਹੈ ਜੋ ਪ੍ਰਿਥਵੀ ਦੀ ਪਰਿਕਰਮਾ ਕਰਦਾ ਹੈ ਇਸ ਚੰਨ ਦੀ ਇੱਕ ਸਰਫੇ ਸੀ ਪ੍ਰਿਥਵੀ ਤੋਂ ਵੇਖੀ ਜਾ ਸਕਦੀ ਹੈ ਕਿਉਂਕਿ ਪ੍ਰਿਥਵੀ ਦੀ ਗ੍ਰੈਵੀਟੇਸ਼ਨ ਫੋਰਸ ਕਰਕੇ ਇਸ ਨੂੰ ਇਹ ਰੁਕ ਗਿਆ ਹੈ ਚੰਨ ਉੱਤੇ ਵਿਗਿਆਨੀਆਂ ਦੁਆਰਾ ਕਾਫੀ ਖੋਜਾਂ ਕੀਤੀਆਂ ਜਾਂਦੀਆਂ ਹਨ ਹਾਲ ਹੀ ਵਿੱਚ ਹੀ ਚੰਨ ਉੱਤੇ ਪਾਣੀ ਦੀ ਮਾਤਰਾ ਵੀ ਪਾਈ ਗਈ ਹੈ ਵਿਗਿਆਨੀਆਂ ਦੁਆਰਾ ਸੈਟੇਲਾਈਟ ਭੇਜ ਕੇ ਉੱਥੇ ਦੀ ਸਰਵਿਸ ਦਾ ਨੁਮਾਇਨਾ ਕੀਤਾ ਜਾਂਦਾ ਹੈ ਅਤੇ ਉਸ ਉਸਦੀ ਮਿੱਟੀ ਵਿੱਚੋਂ ਕਈ ਤੱਤਾਂ ਦੀ ਖੋਜ ਹੋਈ ਹੈ ਜਿਵੇਂ ਮੈਗਨੀਸ਼ੀਅਮ ਨਾਈਟਰੇਟ ਆਦਿ